ਭਾਰਤ ਦੀ ਸਿੱਖਿਆ ਪ੍ਰਣਾਲੀ ਹੁਣ ਅੱਗੇ ਨਾਲ਼ੋਂ ਵਧੀਆ ਹੋ ਚੁੱਕੀ ਹੈ ਅਤੇ ਹੁਣ ਇੱਥੇ ਸਰਕਾਰੀ ਸਕੂਲਾਂ ਵਿੱਚ ਵੀ ਬਹੁਤ ਸੁਧਾਰ ਹੋ ਗਿਆ ਹੈ ਬੱਚਿਆਂ ਨੂੰ ਵਰਦੀ ਦਿੱਤੀ ਜਾਂਦੀ ਹੈ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਕਲਾਸਾਂ ਵੀ ਸਾਫ਼ ਸੁਥਰੀਆਂ ਬਣਾਈਆਂ ਗਈਆਂ ਹਨ ਕੰਪਿਊਟਰ ਵੀ ਲਗਾਏ ਗਏ ਹਨ ਪਰ ਦੂਜੇ ਦੇਸ਼ਾਂ ਵਿੱਚ ਜਿਵੇਂ ਕਿ ਕਿੱਤਾ ਮੁਖੀ ਸਿੱਖਿਆ ਜ਼ਿਆਦਾ ਦਿੱਤੀ ਜਾਂਦੀ ਹੈ ਜਿਸ ਨਾਲ਼ ਬੱਚਿਆਂ ਦੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਹੈ ਉੱਥੇ ਹਰ ਚੀਜ਼ ਕੰਪਿਊਟਰ ਰਾਹੀਂ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾ ਧਿਆਨ ਕਿੱਤਾ ਮੁਖੀ ਸਿੱਖਿਆ 'ਤੇ ਦਿੱਤਾ ਜਾਂਦਾ ਹੈ ਕਿਤਾਬਾਂ ਦੀ ਸਿੱਖਿਆ ਨਾਲੋਂ ਪਰ ਜਿਵੇਂ ਕਿ ਸਾਡੇ ਦੇਸ਼ ਵਿੱਚ ਹੁਣ ਬਹੁਤ ਵਾਧਾ ਹੋ ਰਿਹਾ ਹੈ ਇਸ ਨਾਲ਼ ਸਾਡੇ ਦੇਸ਼ ਵਿੱਚ ਵੀ ਬਾਹਰਲੀ ਸਿੱਖਿਆ ਨੂੰ ਇੱਥੇ ਪ੍ਰਦਾਨ ਕੀਤਾ ਜਾਂਦਾ ਹੈ ਬੱਚਿਆਂ ਨੂੰ ਇਸ ਕਰਕੇ ਹੁਣ ਸਾਡੇ ਦੇਸ਼ ਦੀ ਵੀ ਸਿੱਖਿਆ ਜਿਹੜੀ ਹੈ ਉਹ ਬਹੁਤ ਵਧੀਆ ਹੋ ਚੁੱਕੀ ਹੈ ਹੁਣ ਜਿਹੜੇ ਇੱਥੇ ਸਰਕਾਰੀ ਸਕੂਲ ਨੇ ਇਹਨਾਂ ਵਿੱਚ ਵੀ ਨਵੀਆਂ ਲੈਬਾਂ ਬਣਾਈਆਂ ਗਈਆਂ ਹਨ ਕੰਪਿਊਟਰ ਦਿੱਤੇ ਗਏ ਹਨ ਅਤੇ ਇਸ ਨੂੰ ਹੋਰ ਵਧੀਆ ਕਰਨ ਲਈ ਬੜੇ ਵਧੀਆ ਵਧੀਆ ਜਿਹੜੇ ਨਵੇਂ ਟੈਕਨੋਲੋਜੀ ਦੇ ਕੰਪਿਊਟਰ ਆਏ ਨੇ ਉਹ ਲਗਾਏ ਜਾਣੇ ਚਾਹੀਦੇ ਨੇ ਅਤੇ ਕਲਾਸਾਂ ਨੂੰ ਸਮਾਰਟ ਕਲਾਸਾਂ ਬਣਾ ਦਿੱਤਾ ਜਾਣਾ ਚਾਹੀਦਾ ਹੈ ਬੱਚਿਆਂ ਦੀ ਖੇਡਾਂ ਲਈ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ